ਘਰ ਦੀ ਸਫਾਈ ਰੱਖਣੀ ਬੜੀ ਜ਼ਰੂਰੀ ਹੈ ਆਪਣੇ ਘਰ ਦੀ ਸਫਾਈ ਕਰਕੇ ਅਸੀਂ ਆਪਣੇ ਘਰ ਦਾ ਜੋ ਕੂੜਾ ਕਰਕਟ ਹੈ ਉਹ ਡਸਟਵਿਨ 'ਚ ਪਾਉਂਦੇ ਹਾਂ ਅਤੇ ਡਸਟਬਿਨ ਨੂੰ ਬਾਹਰ ਰੱਖਦੇ ਹਾਂ ਜਦੋਂ ਸਫਾਈ ਕਰਮਚਾਰੀ ਆਉਂਦਾ ਹੈ ਤਾਂ ਉਹ ਡਸਟਬਿਨ ਨੂੰ ਆਪਣੇ ਨਾਲ ਲਿਆਉਂਦੀ ਇੱਕ ਵੱਡੀ ਰੇਹੜੀ ਵਿੱਚ ਅਲੱਗ ਅਲੱਗ ਪਾ ਲੈਂਦਾ ਹੈ ਜੇ ਇੱਕ ਪਾਸੇ ਉਹ ਗਿੱਲਾ ਕੂੜਾ ਅਤੇ ਇੱਕ ਪਾਸੇ ਉਹ ਸੁੱਕਾ ਕੂੜਾ ਪਾਉਂਦਾ ਹੈ ਅਤੇ ਉਸਨੂੰ ਅੱਗੇ ਲਿਜਾ ਕੇ ਉਹ ਜੋ ਖਾਲੀ ਜਗਾ ਸ਼ਹਿਰ ਵਿੱਚ ਹੈਗੀ ਉੱਥੇ ਪਹੁੰਚਾਉਂਦਾ ਹੈ ਅਤੇ ਉਥੋਂ ਉਹ ਵੱਡੇ ਕੰਟੇਨਰਾਂ ਰਾਹੀਂ ਸਫਾਈ ਲਈ ਅੱਗੇ ਭੇਜਿਆ ਜਾਂਦਾ ਹੈ ਜਿਸ ਵਿੱਚੋਂ ਗੁੱਲਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਚੀਜ਼ ਨੂੰ ਗੰਦਗੀ ਤੋਂ ਬਚਾਉਣ ਲਈ ਸਾਨੂੰ ਆਪਣੇ ਘਰ ਦੇ ਕੂੜੇ ਕਰਕਟ ਨੂੰ ਸੜਕਾਂ 'ਤੇ ਨਹੀਂ ਖਿਲਾਰਨਾ ਚਾਹੀਦਾ ਇਸ ਤਰ੍ਹਾਂ ਨਾਲ ਬਿਮਾਰੀਆਂ ਫੈਲਣਗੀਆਂ